ਸਤ ਸ਼੍ਰੀ ਅਕਾਲ ਵੀਰ ਜੀ ਮੈਂ ਉਬਰ ਡਰਾਈਵ ਬੁੱਕ ਕੀਤੀ ਸੀ ਤੁਸੀਂ ਆਪਣੀ ਮੈਨੂੰ ਲੋਕੇਸ਼ਨ ਦੱਸੋਗੇ ਤੁਸੀਂ ਮੇਰੇ ਘਰ ਦੀ ਦਿੱਤੀ ਗਈ ਲੋਕੇਸ਼ਨ 'ਤੇ ਕਿੰਨੇ ਵਜੇ ਤੱਕ ਪਹੁੰਚ ਜਾਓਗੇ ਅਸਲ ਵਿੱਚ ਮੈਨੂੰ ਲੇਟ ਹੋ ਰਿਹਾ ਹੈ ਤੇ ਮੈਂ ਠੀਕ ਦਸ ਮਿੰਟਾਂ ਦੇ ਵਿੱਚ ਘਰੋਂ ਆਪਣੇ ਆਫ਼ਿਸ ਵਾਸਤੇ ਨਿਕਲਣਾ ਹੈ ਤੁਹਾਡੀ ਲੋਕੇਸ਼ਨ ਮੇਰੀ ਲੋਕੇਸ਼ਨ ਤੋਂ ਪੰਦਰ੍ਹਾਂ ਮਿੰਟ ਦੀ ਦੂਰੀ ਤੇ ਆ ਰਹੀ ਹੈ ਤੇ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਮੀਂਹ ਕਾਰਨ ਤੁਹਾਨੂੰ ਹੋਰ ਸਮਾਂ ਤਾਂ ਨਹੀਂ ਲੱਗੇਗਾ ਤੇ ਤੁਸੀਂ ਮੈਨੂੰ ਮੇਰੀ ਲੋਕੇਸ਼ਨ ਦੱਸ ਦਓ ਕੀ ਕਦ ਤੱਕ ਤੁਸੀਂ ਮੇਰੇ ਦਿੱਤੀ ਗਈ ਲੋਕੇਸ਼ਨ ਉੱਤੇ ਪਹੁੰਚੋਗੇ ਤੇ ਮੈਨੂੰ ਇਸ ਨਾਲ ਬਹੁਤ ਆਸਾਨੀ ਹੋ ਜਾਏਗੀ ਤੇ ਮੇਰਾ ਸਮਾਂ ਵੀ ਬਚ ਜਾਵੇਗਾ